ਹੈਲੋ ਸਤਿ ਸ਼੍ਰੀ ਅਕਾਲ ਜੀ ਵਧੀਆ ਤੁਸੀਂ ਕੌਣ ਜੀ ਨੰਬਰ ਭਾਅ ਜੀ ਦੇ ਆਵਾਜ਼ ਤਾਂ ਸੁਣੀ ਨਾਂ ਦੱਸੂਗੇ ਤਾਂ ਪਹਿਛਾਣ ਜੂੰਗਾ ਜੀ ਵਰਿੰ ਆਂ ਭਾਅ ਜੀ ਕੀ ਹਾਲ ਚਾਲ ਆ ਜੀ ਹੋਰ ਕਿੱਧਰ ਰਹਿੰਦੇ ਅੱਜ ਕੱਲ੍ਹ ਤਾਂ ਮਿਲਦੇ ਵੀ ਨਹੀਂ ਹੈ ਤੁਸੀਂ ਘਰ ਪਰਿਵਾਰ ਕਿੱਦਾਂ ਜੀ ਨਹੀਂ ਨਹੀਂ ਫੋਨ ਜਿਹੜਾ ਮੇਰਾ ਖ਼ਰਾਬ ਜਿਹਾ ਹੋ ਗਿਆ ਤਾ ਜੀ ਉਹਦੇ ਚੱਕਰ 'ਚ ਚੇਂਜ ਕੀਤਾ ਕਾਫ਼ੀ ਨੰਬਰ ਜਿਹੜੇ ਨਾ ਡਿਲੀਟ ਜਿਹੇ ਹੋ ਗਏ ਅਤੇ ਉਹਦੇ ਚੱਕਰ 'ਚ ਮੈਂ ਲੱਭਦਾ ਵੀ ਰਿਹਾ ਪਰ ਮੈਨੂੰ ਕਈਆਂ ਦੇ ਹਜੇ ਵੀ ਨੰਬਰ ਮਿੱਸ ਹੈ ਜੀ ਸਭ ਠੀਕ ਹੈ ਜੀ ਤੁਸੀਂ ਦੱਸੋ ਤੁਹਾਡੇ ਕੰਮ ਕਾਰ ਕਿੱਦਾਂ ਚੱਲਦੇ ਜੀ ਹਾਂ ਸਭ ਠੀਕ ਹੈ ਜੀ ਤੁਸੀਂ ਦੱਸੋ ਹਾਂ ਸਭ ਵਧੀਆ ਚ ਲੱਗੇ ਵੇ ਆਪਣੇ ਕੰਮ ਕਾਰ

ਹੋਰ ਹਾਂਜੀ ਹਾਂਜੀ ਦੱਸੋ ਜੀ ਤੁਸੀਂ ਮਤਲਬ ਪੰਜਾਬ ਦੇ ਇਤਿਹਾਸ ਬਾਰੇ ਜਾਣਨਾ ਚਾਹੁੰਦੇ ਜਿਵੇਂ ਕਿ ਖੇਤੀਬਾੜੀ ਐਰਾ ਵਗੈਰਾ ਜਾਂ ਕੁਛ ਵੀ ਦੇਖੋ ਜੀ ਪੰਜਾਬ ਹਾਂ ਪੰਜਾਬ ਦੇ ਤੁਸੀਂ ਇਕੱਲੀ ਪੰਜਾਬ ਦੀ ਤਾਂ ਇਤਿਹਾਸ ਪੰਜਾਬ ਦੇ ਮਾਡਰਨ ਅੱਜ ਦੇ ਮਤਲਬ ਪਿੱਛੋਂ ਤੋਂ ਲੈ ਕੇ ਅੱਜ ਦੇ ਯੁੱਗ ਤੱਕ ਜਿਹੜਾ ਪੰਜਾਬ ਤਾ ਉਹ ਸਾਡਾ ਪੰਜਾਬ ਹੈ ਜੀ ਮਨੀਸ਼ ਜਿੰਦਲ ਹਾਂਜੀ ਮਨੀਸ਼ ਜਿੰਦਲ ਦੀ ਹੈ ਜੀ ਕਿਤਾਬ ਉਹਦੇ ਵਿੱਚ ਪੰਜਾਬ ਦੇ ਗੁਰੂਆਂ ਬਾਰੇ ਸਾਡੇ ਸੱਭਿਆਚਾਰ ਪੁਰਾਣਾ ਸਾਡੇ ਆਜ਼ਾਦੀ ਮੋਡਰਨ ਜਿਹੜੇ ਜੋ ਸਾਡੇ ਵੀਰਾਂ ਨਾਲ ਭਾਗ ਲਿਆ ਆਜ਼ਾਦੀ ਦੇ ਵਿੱਚ ਉਹਦੇ ਬਾਰੇ ਦੱਸਿਆ ਗਿਆ ਜੀ ਹੈ ਨਾ ਉਹਦੇ ਉਹਦੇ ਵਿੱਚ ਸਾਰੀ ਜਾਣਕਾਰੀ ਅਗਰ ਤੁਸੀਂ ਖੇ ਨਾਲੇ ਖੇਤੀਬਾੜੀ ਜਿੱਦਾਂ ਹੁਣ ਐਗਰੀਕਲਚਰ ਐਰਾ ਵਗੈਰਾ ਕਰਨਾ ਚਾਹੁੰਦੇ ਹੋ ਤਾਂ ਹਾਂ ਫਿਰ ਉਹਦੇ ਵਾਸਤੇ ਇੱਕ ਜੀ ਦੁੱਗਲ ਦੀ ਹੈ ਜੀ ਕਿਤਾਬ ਜਿਹੜਾ ਪੰਜਾਬ ਖੇਤੀਬਾੜੀ ਉਹਦੇ 'ਚ ਦੱਸਿਆ ਵਾ ਕਿ ਪੁਰਾਣੇ ਸਾਡੇ ਕਿੱਦਾਂ ਖੇਤੀਬਾੜੀ ਕਰਦੇ ਤੇ ਅੱਜ ਦਾ ਕੀਟਨਾਸ਼ਕ ਦੂਰ ਰਹਿਣ ਲਈ ਬਹੁਤ ਵਧੀਆ ਮੈਂ ਵੀ ਆਪਣੇ ਸਕੂਲ ਦੇ ਬੱਚਿਆਂ ਨੂੰ ਇਹ ਹੀ ਸਜੇਸਨ ਕਰਦਾ ਕਿ ਇਹ ਕਿਤਾਬ ਤੁਸੀਂ ਪੜ੍ਹੋ ਤਾਂ ਜੋ ਆਪਣੇ ਪੇਰੈਂਟਸ ਨੂੰ ਦੱਸੋ ਕਿ ਮੈਂ ਵਧੀਆ ਖੇਤੀ ਕਿੱਦਾਂ ਕੀਤੀ ਜਾਂਦੀ ਹੈ ਜੀ ਹਾਂਜੀ ਹਾਂਜੀ ਹਾਂਜੀ ਦੁੱਗਲ ਵਾਲੀ ਕਿਤਾਬ ਦਾ ਨਾਮ ਹੈ ਜੀ ਖੇਤੀਬਾੜੀ ਪੰਜਾਬ ਹਾਂਜੀ ਹਾਂਜੀ ਹਾਂ ਮਨੀਸ਼ ਜਿੰਦਲ ਦੀ ਇਹ ਤੁਹਾਨੂੰ ਪੰਜਾਬ ਦੇ ਪੂਰੇ ਹਿਸਟਰੀ ਪ੍ਰੋਪਰ ਕਵਰ ਕਰਾ ਦੱਸ ਦੂੰਗੀ ਵੀ ਕਿਸ ਤਰ੍ਹਾਂ ਕਿੱਦਾਂ ਸਿੱਖ ਇਤਿਹਾਸ ਵਾਸਤੇ ਵੀ ਜਿੰਨੇ ਜਿੰਨੇ ਜਿਦਾਂ ਪੰਜਾਬ 'ਚ ਹੁਣ ਪੰਜਾਬ 'ਚ ਜਾਂ ਐਂਟਰ ਰਿਹਾ ਜੀ ਆਪਣੇ ਇੰਡੀਆ ਦਾ ਭਾਰਤ ਕਿਸੇ ਨੇ ਵੀ ਆਉਣਾ ਦਾ ਤਾਂ ਉਹ ਪੰਜਾਬ 'ਚ ਹੋ ਕੇ ਹੀ ਆਉਂਦਾ ਹੁੰਦਾ ਸੀ ਹੈ ਨਾ ਜੀ ਤੇ ਉਸ ਬਾਰੇ ਵਿੱਚ ਦੱਸਿਆ ਗਿਆ ਜਿਹਦੇ ਨਾਲ ਫਿਰ ਪੰਜਾਬ 'ਚ ਕਿੱਦਾਂ ਕਿੱਦਾਂ ਹੋਰ ਭਾਸ਼ਾ ਦਾ ਜਿਹਦਾ ਬਦਲਾਵ ਹੋਇਆ ਹਾਂਜੀ ਉਹ ਸਾਰਾ ਕੁਝ ਐਰਾ ਵਗੈਰਾ ਜਿਹੜਾ ਦੱਸਿਆ ਗਿਆ ਹੈ ਹਾਂ ਹੋਰ ਹੋਰ ਬਾਕੀ ਤੁਸੀਂ ਦੇਖ ਸਕਦੇ ਹੋ ਜਿੱਦਾਂ ਵੀ ਹੋਊਂਗਾ ਹਾਂਜੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਪੂਰੀ ਕੋਈ ਉਹ ਨਹੀਂ ਹੈ ਇਸ 'ਚ ਤੁਸੀਂ ਅਗਾਂਹ ਅਗਰ ਤੁਸੀਂ ਅਗਰ ਤੁਸੀਂ ਟੈਸਟਿੰਗ ਵੀ ਦੇਖਣਾ ਚਾਹੁੰਦੇ ਹੋ ਤੁਸੀਂ ਐਂ ਕਰਿਓ ਆਪਣੇ ਜਿਲ੍ਹੇ ਦੀ ਲਾਇਬਰੇਰੀ 'ਚ ਜਾ ਆਇਓ ਓ ਹਾਂ ਤੁਸੀਂ ਇੱਕ ਵਾਰ ਚੈੱਕ ਕਰ ਲਿਓ ਜੇ ਤੁਹਾਨੂੰ ਵਧੀਆ ਲੱਗੇ ਤੁਸੀਂ ਆਪਣੀ ਇੱਕ ਬਾਏ ਕਰ ਲਿਓ ਨਹੀਂ ਤਾਂ ਤੁਸੀਂ ਲਾਈਬ੍ਰੇਰੀ 'ਚ ਜਾ ਕੇ ਵੀ ਲੈ ਸਕਦੇ ਪਰ ਕਾਹਨੂੰ ਉਹ ਕਰਨਾ ਤੁਸੀਂ ਆਪਣੀ ਇੱਕ ਨਵੀਂ ਫ੍ਰੈਸ਼ ਲਿਓ ਨਾਲੇ ਲੇਟੈਸਟ ਵਰਜ਼ਨ ਲਿਓ ਜੀ ਹਾਂ ਤੁਹਾਨੂੰ ਫਿਰ ਇੱਦਾਂ ਨਾ ਫਿਰ ਮ ਹਾਂਜੀ ਹਾਂਜੀ ਉਹ ਲਗਭਗ ਮਾਰਕੀਟ 'ਚ ਆ ਗਿਆ ਤੁਸੀਂ ਡਿਸਟ੍ਰਿਕ ਸਾਡੇ ਵੱਲ ਤਾਂ ਨਹੀਂ ਹੈ ਅਤੇ ਡਿਸਟਰਿਕਟ 'ਚ ਆ ਕੇ ਤੁਸੀਂ ਉੱਥੇ ਲੈ ਕੇ ਲੈ ਸਕਦੇ ਹੋ

ਬਾਕੀ ਟੈਮ ਟੂਮ ਕੱਢ ਕੇ ਮਿਲਣ ਆ ਜਾਇਓ ਜੀ ਠੀਕ ਹੈ ਜੀ